ਮੈਂ ਹਰ ਰੋਜ਼ ਲਗਭਗ ਇੱਕ ਦੋ ਘੰਟੇ ਗਾਉਣ ਦੀ ਪ੍ਰੈਕਟਿਸ ਕਰਦਾ ਹਾਂ ਹਾਲਾਂਕਿ ਕਈ ਵਾਰ ਇਹ ਸਮਾਂ ਮੇਰੀ ਰੁਚੀ ਅਤੇ ਦਿਲਚਸਪੀ ਅਨੁਸਾਰ ਵੱਧ ਜਾ ਘੱਟ ਹੋ ਜਾਂਦਾ ਹੈ ਮੈਂ ਪਹਿਲਾਂ ਸੁਰ ਤੈਅ ਕਰਕੇ ਰਿਆਜ਼ ਕਰਦਾ ਹਾਂ ਜਿਸ ਨਾਲ ਮੇਰੀ ਆਵਾਜ਼ ਗਰਮ ਹੋ ਜਾਂਦੀ ਹੈ ਮਤਲਬ ਸ਼ੁਰੂਆਤ ਵਿੱਚ ਥੋੜ੍ਹੀ ਜਿਹੀ ਉੱਦਾਂ ਹੀ ਸਹਿ ਸੁਰ ਸਰ ਸੈਟ ਕਰਕੇ ਆਪਣੀ ਆਵਾਜ਼ ਗਰਮ ਕਰਦਾ ਹਾਂ ਫਿਰ ਉਸ ਤੋਂ ਬਾਅਦ ਗੀਤ ਸਿੱਖਣ ਲਈ ਮੈਂ ਸਭ ਤੋਂ ਪਹਿਲਾਂ ਉਸਦੇ ਬੋਲ ਅਤੇ ਧੁਨ ਨੂੰ ਧਿਆਨ ਨਾਲ ਸੁਣਦਾ ਹਾਂ ਫਿਰ ਮੈਂ ਇਸ ਦੀ ਲੈਅ ਅਤੇ ਤਾਲ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਈ ਵਾਰ ਮੈਂ ਯੂਟੀਊਬ ਜਾਂ ਕੋਈ ਹੋਰ ਆਨਲਾਈਨ ਸਰੋਤਾਂ ਤੋਂ ਵੀ ਮਦਦ ਲੈਂਦਾ ਹਾਂ ਜੇਕਰ ਗੀਤ ਸ਼ਾਸਤਰੀ ਸੰਗੀਤ ਨਾਲ ਜੁੜਿਆ ਹੋਇਆ ਹੈ ਤਾਂ ਮੈਂ ਉਸਦੇ ਰਾਗ ਅਤੇ ਤਕਨੀਕ ਨੂੰ ਵੀ ਵਿਸ਼ੇਸ਼ ਤੌਰ 'ਤੇ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ ਮੈਂ ਮੰਨਦਾ ਹਾਂ ਕੀ ਨਿੱਤ ਰਿਆਜ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਿਰਫ਼ ਗਾਇਕੀ ਨੂੰ ਸਵਾਰਦਾ ਵੀ ਨਹੀਂ ਸਗੋਂ ਆਵਾਜ਼ ਨੂੰ ਵੀ ਮਜ਼ਬੂਤ ਅਤੇ ਸੁਰੀਲਾ ਬਣਾਉਂਦਾ ਹੈ ਅਤੇ ਮੈਨੂੰ ਲੋਕਾਂ ਵਿੱਚ ਆਪਣੇ ਦੋਸਤਾਂ ਨਾਲ ਗਾਣਾ ਦਾ ਬਹੁਤ ਸ਼ੌਂਕ ਹੈ